ਸਾਡੇ ਪਿੰਡ ਵਿੱਚ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਉਹਨਾਂ ਨੂੰ ਪੋਲੀਓ ਦੀਆਂ ਬੂੰਦਾਂ ਲਗਵਾਈਆ ਜਾਂਦੀਆਂ ਹਨ ਕਿਉਂਕਿ ਛੋਟੇ ਬੱਚਿਆਂ ਨੂੰ ਹੀ ਪੋਲੀਓ ਤੋਂ ਸਾਰਾ ਨਾਲੋਂ ਵੱਧ ਖਤਰਾ ਹੁੰਦਾ ਤੇ ਅਜੋਕੇ ਸਮੇਂ ਵਿੱਚ ਹਰ ਇੱਕ ਮਾਂ ਬਾਪ ਬੱਚੇ ਦਾ ਬਹੁਤ ਹੀ ਧਿਆਨ ਰੱਖਦਾ ਤਾਂ ਕਿ ਉਹਨਾਂ ਦਾ ਪੋਲੀਓ ਤੋਂ ਬਚਾਅ ਰਹੇ ਤੇ ਅੱਜਕੱਲ ਹਰ ਇੱਕ ਮਾਂ ਬਾਪ ਨੂੰ ਸਮੇਂ ਸਮੇਂ ਤੇ ਸਰਕਾਰ ਦੇ ਸਕੀਮਾਂ ਰਾਹੀਂ ਦੱਸਿਆ ਜਾਂਦਾ ਕਿ ਬੱਚੇ ਨੂੰ ਪੋਲੀਓ ਤੋਂ ਬਚਾਉਣ ਲਈ ਪੋਲੀਓ ਦੀਆਂ ਬੂੰਦਾਂ ਲਗਵਾਈਆਂ ਜਾਣ ਤੇ ਜਿਸ ਕਰਕੇ ਹਰ ਮਾਂ ਬਾਪ ਪੂਰੀ ਆਪਣੇ ਬੱਚੇ ਦੀ ਦੇਖਭਾਲ ਲਈ ਪੋਲੀਓ ਦੀਆਂ ਬੁੰਦਾਂ ਸਮੇਂ ਸਿਰ ਲਵਾ ਲੈ ਲਓ ਉਹਦਾ ਮੇਨ ਕਾਰਨ ਕਿ ਉਸਦਾ ਬੱਚਾ ਕਿਸੇ ਪ੍ਰਕਾਰ ਦੀ ਬਿਮਾਰੀ ਤੋਂ ਦੂਰ ਰਹੇ ਤੇ ਇਹੀ ਉਸ ਦਾ ਮੇਨ ਕਾਰਨ ਮੇਰੇ ਬੱਚੇ ਨੂੰ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਾ ਹੋਵੇ ਤੇ ਉਹ ਭਵਿੱਖ ਵਿੱਚ ਇਕ ਤੰਦਰੁਸਤ ਸਰੀਰ ਰਹੇ ਤੇ ਜਿਸ ਕਾਰਨ ਹਰ ਇੱਕ ਮਾਂ ਬਾਪ ਪੰਜ ਸਾਲ ਤੱਕ ਪਹਿਲੀ ਆਪਦੇ ਬੱਚੇ ਨੂੰ ਪੋਲੀਓ ਦੀਆਂ ਬੂੰਦਾ ਲਵਾ ਲੈਂਦਾ ਹੈ ਕਿਉਂਕਿ ਛੋਟੇ ਹੁੰਦੇ ਬੱਚੇ ਦੀਆਂ ਪੋਲੀਓ ਬੂੰਦਾਂ ਫਰੀ ਵਿੱਚ ਸਰਕਾਰੀ ਹਸਪਤਾਲ ਵਿੱਚ ਲਗਾਈਆਂ ਜਾਂਦੀਆਂ ਹਨ